ਮੇਰੀ ਮਨਪਸੰਦ ਫੋਟੋ ਮੇਰੇ ਵਿਆਹ ਦੀ ਐਲਬਮ ਹੈ ਕਿਉਂ ਉਸ ਦੇ ਵਿੱਚ ਸਾਰੇ ਰਿਸ਼ਤੇਦਾਰ ਭੈਣ ਭਰਾ ਨਾਲ ਫੋਟੋਆਂ ਖਿਚਵਾਈਆਂ ਇਸ ਕਰਕੇ ਮੈਨੂੰ ਬਹੁਤ ਚੰਗੀਆਂ ਲੱਗੀਆਂ ਮਾਮੇ ਤਾਏ ਚਾਚੇ ਸਾਰਿਆਂ ਨੇ ਮੇਰੇ ਨਾਲ ਫੋਟੋਆਂ ਖਿਚਵਾਈਆਂ ਐਲਬਮ ਹੈ ਪੂਰੀ ਬਣੀ ਪਈ ਉਹ ਐਲਬਮ ਵੇਖ ਕੇ ਅਜੇ ਵੀ ਮੈਂ ਆਪਣੀਆਂ ਤਾਜ਼ਾ ਜਾਦੀਆ ਤਾਜ਼ਾ ਤਾਜ਼ਾ ਯਾਦ ਕਰਦਾ ਹਾਂ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਦੋਂ ਹੁਣ ਵੀ ਮੈਂ ਵੇਖਦਾ ਮੈਨੂੰ ਬਹੁਤ ਘੈਂਟ ਲੱਗਦੀ ਹੈ ਫੋਟੋਆਂ ਬਹੁਤ ਵਧੀਆ ਲੱਗਦੀਆਂ ਮੈਨੂੰ